ਕੋਈ ਵੀ ਨਵਜਾਤ ਬੱਚੇ ਨੂੰ ਫੜਨ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਅਕਸਰ ਸਾਬਣ ਨਾਲ ਧੋਣਾ ਚਾਹੀਦਾ ਹੈ ਬੱਚੇ ਨੂੰ ਮੈਲੇ ਖਾਦ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਜਿਵੇਂ ਕਿ ਬੱਚੇ ਨੂੰ ਕੁੱਤੇ ਜਾਂ ਹੋਰ ਜੰਤੂਆਂ ਦੇ ਨੇੜੇ ਨਾ ਲਿਆਇਆ ਜਾਵੇ ਬੱਚੇ ਨੂੰ ਨਹਾਉਣ ਲਈ ਨਿੱਘਰ ਪਾਣੀ ਨਾਲ ਸਫਾਈ ਕਰਨੀ ਚਾਹੀਦੀ ਹੈ ਨਿੱਘਰ ਪਾਣੀ ਨਾਲ ਬੱਚੇ ਦੇ ਮੂੰਹ ਅੱਖਾਂ ਨੱਕ ਦੀ ਸਫਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ ਇਸ ਲਈ ਨਰਮ ਕੱਪੜੇ ਜਾਂ ਕਾਟਨ ਦੀ ਵਰਤੋਂ ਕਰ ਸਕਦੇ ਹਾਂ ਬੱਚੇ ਨੂੰ ਡਾਈਪਰ ਹਰ ਤਿੰਨ ਜਾਂ ਚਾਰ ਘੰਟੇ ਤੋਂ ਬਾਅਦ ਬਦਲ ਦੇਣਾ ਚਾਹੀਦਾ ਹੈ ਬੱਚੇ ਨੂੰ ਨਹਾਉਣ ਲਈ ਨਰਮ ਸਾਬਣ ਦੀ ਵਰਤੋਂ ਕਰਨੀ ਚਾਹੀਦੀ ਹੈ ਬੱਚੇ ਦੀ ਅੰਦਰੂਨੀ ਸਫਾਈ ਦਾ ਵੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦੀ ਗੰਦਗੀ ਜਿੱਥੇ ਬੱਚਾ ਰੱਖਿਆ ਹੋਇਆ ਹੈ ਉੱਥੇ ਨਹੀਂ ਹੋਣੀ ਚਾਹੀਦੀ ਸਫਾਈ ਕਰਨ ਤੋਂ ਬਾਅਦ ਬੱਚੇ ਦੇ ਸਰੀਰ ਨੂੰ ਖੁਸ਼ਕ ਰੱਖਣਾ ਚਾਹੀਦਾ ਹੈ ਖਾਸ ਕਰਕੇ ਐਦਾਂ ਦੇ ਸਥਾਨਾਂ ਉੱਤੇ ਜਿੱਥੇ ਜ਼ਿਆਦਾਤਰ ਪਾਣੀ ਗਿਰਿਆ ਹੋਵੇ ਬੱਚੇ ਦੀ ਸਫਾਈ ਲਈ ਕਿਸੇ ਵੀ ਤਰ੍ਹਾਂ ਦੇ ਤਿੱਖੇ ਉਪਕਰਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੇਕਰ ਫਿਰ ਵੀ ਕੋਈ ਚਿੰਤਾ ਹੋਵੇ ਤਾਂ ਆਪਣੇ ਡਾਕਟਰ ਨਾਲ ਸਲਾਹ ਕਰਨੀ ਚਾਹੀਦੀ ਹੈ